ਹੈਲੋ ਹਾਂਜੀ ਸਵਰਜੀਤ ਸਿੰਘ ਜੀ ਮਹਾਂ ਪੁਰਸ਼ੋ ਕੀ ਹਾਲ ਚਾਲ ਤੁਹਾਡੇ ਠੀਕ ਠਾਕ ਵਧੀਆ ਓ ਮਹਾਰਾਜ ਤੁਹਾਡੇ ਦਰਸ਼ਨ ਨਹੀਂ ਹੋਏ ਓ ਆਪਣਾ ਜਿਹੜਾ ਰਿਪੇਅਰ ਦਾ ਕੰਮ ਰਹਿੰਦਾ ਸੀ ਉਹਦਾ ਮੁੜ ਕੇ ਕਦੋਂ ਕਰਨਾ ਓ ਢੋਅ ਤਾਂ ਲੱਗੀ ਹੈ ਮਹਾਂ ਪੁਰਸ਼ੋ ਉਹਦੀ ਉਹ ਮੋਲਡਿੰਗ ਵੀ ਲਾ ਦੇਣੀ ਸੀ ਜਿਹੜੀ ਇੱਕ ਲੱਕੜ ਦਾ ਰਹਿੰਦਾ ਕੰਮ ਬਾਕੀ ਦਾ ਓ ਭਰਾਵਾਂ ਉੱਦਣ ਦੀ ਉਵੇਂ ਦੀ ਉਵੇਂ ਪਈ ਹੈ ਇੱਕ ਓ ਕਿਚਨ ਦਾ ਵੀ ਦੇਖੀਏ ਯਾਰ ਜਿਹੜਾ ਉਹਦਾ ਕਰਨ ਵਾਲਾ ਟਾਇਮ ਹੀ ਨਹੀਂ ਲੱਗ ਰਿਹਾ ਤੁਹਾਡਾ ਹੂੰ ਨਹੀਂ ਨਹੀਂ ਉਹਨੂੰ ਲੰਬਾ ਨਾ ਨਾ ਖਿੱਚੀਏ ਉਹਨੂੰ ਥੋੜ੍ਹਾ ਛੋਟਾ ਕਰ ਲਈਏ ਇਹ ਹੁਣ ਤੁਸੀਂ ਵੇਖੋ ਵੀ ਬਾਹਰ ਦੇ ਫਰੇਮ ਫਰੂਮ ਜਿਹੜੇ ਉਹਦੇ ਲਗਾਓਣੇ ਹੈ ਜਿਹੜੇ ਸਿਊਂਕ ਨੇ ਖਾ ਲਏ ਹੈ ਉਹ ਦਰਾਜ ਦਰੂਜ ਖ਼ਰਾਬ ਹੋਏ ਹੈ ਉਹਨਾ ਦਾ ਕੀ ਕਰੀਏ ਸੈਟਿੰਗ ਕੋਈ

ਤੁਸੀਂ ਮਹਾਰਾਜ ਮੁੜ ਕੇ ਆਏ ਹੀ ਨਹੀਂ ਨਾ ਤੁਸੀਂ ਦੱਸਿਆ ਹੀ ਕੁਛ ਚੰਗੇ ਗਾਇਬ ਹੋਏ ਜੇ ਅੱਛਾ ਕਿਤੇ ਕੰਮ ਕਰ ਰਹੇ ਜਰੂਰੀ ਕੰਮ ਕਰ ਰਹੇ ਅੱਜ ਕੱਲ੍ਹ ਕਿਤੇ

ਨਿਊ ਅੰਮ੍ਰਿਤਸਰ ਅੱਛਾ ਅੱਛਾ ਚਲੋ ਆਪਣਾ ਵੀ ਦੇਖ ਲਿਓ ਯਾਰ ਆਪਣਾ ਵੀ ਬਥੇਰਾ ਟਾਇਮ ਹੋ ਗਿਆ ਕਰੀਏ ਕੰਮ ਨਬੇੜੀਏ ਹਾਂ ਚਲੋ ਠੀਕ ਹੈ ਫਿਰ ਓਕੇ ਕਰਦੇ ਹਾਂ ਕੰਮ ਓਕੇ ਬਾਏ